ਹੈਲੋ ਤੁਸੀਂ ਮੀਸ਼ੋ ਤੋਂ ਗੱਲ ਕਰ ਰਹੇ ਓਂ ਮੈਂ ਕੁਛ ਦਿਨ ਪਹਿਲਾਂ ਤੁਹਾਡੀ ਐਪ ਦੇ ਉੱਪਰ ਇੱਕ ਸਾੜੀ ਦੇਖੀ ਸੀ ਜੋ ਕਿ ਮੈਨੂੰ ਬਹੁਤ ਪਸੰਦ ਆਈ ਜਿਸ ਦਾ ਰੰਗ ਵੀ ਮੈਨੂੰ ਬਹੁਤ ਪਸੰਦ ਸੀ ਮੈਂ ਬਹੁਤ ਖੁਸ਼ ਸੀ ਮੈਂ ਸੋਚਿਆ ਕਿ ਮੈਂ ਲਵਾਂ ਜਾਂ ਨਾ ਲਵਾਂ ਪਰ ਮੈਂ ਫਿਰ ਓਰਡਰ ਕਰ ਲਈ ਇਸ ਵਿੱਚ ਮੈਂ ਵੇਖਿਆ ਸੀ ਕਿ ਇੱਕ ਸਾੜੀ ਬਹੁਤ ਸੋਹਣੀ ਸੀ ਜਦੋਂ ਮੇਰੇ ਕੋਲ ਪਾਰਸਲ ਆਇਆ ਤਾਂ ਉਹ ਉੱਪਰ ਬਹੁਤ ਸੋਹਣਾ ਪੈਕ ਕੀਤਾ ਹੋਇਆ ਸੀ ਮੈਂ ਇਹ ਸਾੜੀ ਖੋਲ੍ਹ ਕੇ ਦੇਖੀ ਬਹੁਤ ਕੱਪੜਾ ਸੋਹਣਾ ਸੀ ਪਰ ਜਦੋਂ ਖੋਲ੍ਹ ਕੇ ਦੇਖੀ ਤਾਂ ਇਹ ਫੱਟੀ ਹੋਈ ਸੀ ਤਾਂ ਮੈਨੂੰ ਬਹੁਤ ਦੁੱਖ ਹੋਇਆ ਜਾਂ ਤਾਂ ਮੈਨੂੰ ਇਹ ਸਾੜੀ ਤੁਸੀਂ ਬਦਲ ਕੇ ਦੇ ਦਿਓ ਮੇਰਾ ਡੈਬਿਟ ਕਾਰਡ ਇਹਦੇ ਨਾਲ ਅਟੈਚ ਹੈ ਜਾਂ ਫਿਰ ਮੈਨੂੰ ਤੁਸੀਂ ਇਹ ਪੈਸੇ ਰੀਫੰਡ ਕਰ ਦਓ ਮੈਂ ਮੈਂ ਦੇਖਿਆ ਕਿ ਤੁਹਾਡੇ ਐਪ ਉੱਪਰ ਇਹ ਸਾੜੀ ਅਜੇ ਵੀ ਉਪਲਬਧ ਹੈ ਜੋ ਕਿ ਤੁਸੀਂ ਮੈਨੂੰ ਬਦਲ ਕੇ ਦੇ ਸਕਦੇ ਹੋ ਤੁਸੀਂ ਮੈਨੂੰ ਇਹ ਸਾੜੀ ਬਦਲ ਕੇ ਦੇ ਦਿਓ ਅਤੇ ਤੁਸੀਂ ਮੈਨੂੰ ਜਾਂ ਫਿਰ ਪੈਸੇ ਰੀਫੰਡ ਕਰ ਦਓ ਮੇਰਾ ਪਾਰਸਲ ਨੰਬਰ ਚਾਰ ਛੇ ਅੱਠ ਹੈ ਧੰਨਵਾਦ